ਹੈਲੋ ਤੁਸੀਂ ਐਮਾਜ਼ਾਨ ਤੋਂ ਬੋਲ ਰਹੇ ਹੋ ਮੈਨੂੰ ਨਾ ਆਪਣਾ ਇੱਕ ਫੀਡਬੈਕ ਦੇਣਾ ਸੀ ਆਪਣੇ ਇੱਕ ਪ੍ਰੋਡਕਟ ਬਾਰੇ ਹਾਲ ਹੀ 'ਚ ਮੈਂ ਇੱਕ ਈ ਬੁੱਕ ਆਰਡਰ ਕੀਤੀ ਸੀ ਬੁੱਕ ਦਾ ਨਾਂ ਸੀ ਡੂ ਐਪਿਕ ਸ਼ਿਟ ਅਤੇ ਦੂਜੀ ਬੁੱਕ ਦਾ ਨਾਂ ਸੀ ਗੈਟ ਐਪਿਕ ਸ਼ਿਟ ਡੰਨ ਇਹ ਇੱਕ ਅੰਕੁਰ ਵਾਰਿਕੂ ਦੀ ਬੁੱਕ ਸੀ ਜਿਹੜੀ ਕਿ ਉਹਨਾਂ ਨੇ ਔਨਲਾਈਨ ਐਮਾਜ਼ਾਨ 'ਤੇ ਪਾਈ ਹੋਈ ਸੀ ਅਤੇ ਜਿੱਦਾਂ ਹੀ ਉਹ ਮੇਰੇ ਕੋਲ ਆਈ ਮੈਂ ਲਗਭਗ ਉਹ ਦੋ ਕੁ ਡਾਲਰ 'ਚ ਖਰੀਦੀ ਸੀ ਅਤੇ ਮੈਂ ਉਹਦੇ ਬਾਰੇ ਕੁੱਛ ਪੋਜ਼ੀਟਿਵ ਫੀਡਬੈਕ ਦੇਣਾ ਚਾਹੁੰਦਾ ਹਾਂ ਅਤੇ ਉਸ ਦਾ ਜਿਹੜਾ ਪਹਿਲਾ ਚੈਪਟਰ ਸੀ ਉਹ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਜਿਸ 'ਚ ਇਹ ਸਮਝਾਇਆ ਗਿਆ ਸੀ ਕਿ ਆਪਾਂ ਕਿੱਦਾਂ ਅਗਲੇ ਬੰਦੇ ਨਾਲ਼ ਸਾਨੂੰ ਕੰਮਪੇਅਰ ਨਹੀਂ ਕਰਨਾ ਚਾਹੀਦਾ ਕਦੀ ਵੀ ਅਤੇ ਜੇ ਕਰਨਾ ਵੀ ਚਾਹੀਦਾ ਤਾਂ ਉਹ ਕਿਹੜੇ ਕਿਹੜੇ ਵਧੀਆ ਸਿਚੁਏਸ਼ਨ ਜਾਂ ਫੈਕਟਰਸ ਹੁੰਦੇ ਹੈ ਜਿਹਦੇ ਨਾਲ਼ ਆਪਾਂ ਕੰਮਪੇਅਰ ਕਰ ਸਕਦੇ ਹਾਂ ਅਤੇ ਆਪਣੇ ਜਿਹੜੇ ਬੋਲਣ ਦੇ ਤਰੀਕੇ ਹੁੰਦੇ ਹੈ ਜ਼ਿੰਦਗੀ 'ਚ ਸਾਨੂੰ ਕਿੱਦਾਂ ਸੋਚ ਵਿਚਾਰ ਕਰਕੇ ਆਪਣੀ ਚੀਜ਼ਾਂ ਅੱਗੇ ਲੋਕਾਂ ਮੂਹਰੇ ਰੱਖਣੀਆਂ ਚਾਹੀਦੀਆਂ ਹਨ ਉਹ ਸਾਰੀ ਚੀਜ਼ਾਂ ਇਸ ਬੁੱਕ 'ਚ ਅੰਕੁਰ ਵਾਰਿਕੂ ਨੇ ਬੜੇ ਹੀ ਚੰਗੇ ਤਰੀਕੇ ਨਾਲ਼ ਦੱਸਿਆ ਹੋਇਆ ਹੈ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾ ਐਮਾਜ਼ਾਨ ਦੀ ਡਿਲੀਵਰੀ ਸਿਸਟਮ ਦੀ ਉਹ ਔਨਲਾਈਨ ਡਿਲੀਵਰੀ ਸਿਸਟਮ ਬਹੁਤ ਹੀ ਜ਼ਿਆਦਾ ਫਾਸਟ ਸੀ ਜਿੱਦਾਂ ਹੀ ਮੈ ਉਹਨੂੰ ਆਰਡਰ ਕੀਤਾ ਦੋ ਕੁ ਘੰਟੇ 'ਚ ਉਹ ਮੇਰੇ ਐਪ 'ਚ ਡਿਲੀਵਰ ਹੋ ਗਈ ਸੀ ਅਤੇ ਇੱਕ ਚੀਜ਼ ਜਿਹੜੀ ਕਿ ਮੈਨੂੰ ਬਹੁਤ ਹੋਰ ਵੀ ਜ਼ਿਆਦਾ ਵਧੀਆ ਲੱਗੀ ਅਤੇ ਜਿਹੜਾ ਮੈਨੂੰ ਡਿਸਕਾਊਂਟ ਮਿਲਿਆ ਟਵੰਟੀ ਪ੍ਰਸੈਂਟ ਦਾ ਅਤੇ ਜਿਹੜੀਆਂ ਮੈਂ ਇਹ ਬੁੱਕ ਲਈਆਂ ਹੈ ਇਹਨਾਂ ਨੂੰ ਮੈਂ ਆਪਣੇ ਅੱਗੇ ਦੋਸਤਾਂ ਨਾਲ਼ ਵੀ ਅੱਗੇ ਸ਼ੇਅਰ ਕਰ ਸਕਦਾ ਹਾਂ